ਸਾਡੇ ਖੇਤਰ ਵਿੱਚ ਰੇਤਾ ਇੱਕ ਕੁਦਰਤੀ ਸਰੋਤ ਹੈ ਜਿਹੜਾ ਕਿ ਵਪਾਰਕ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ ਜਿਹੜਾ ਕਿ ਪੂਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਭੇਜਿਆ ਜਾਂਦਾ ਹੈ ਰੇਤਾ ਕੰਸਟਰਕਸ਼ਨ ਵਿਚ ਕੰਮ ਆਉਂਦਾ ਹੈ ਬਿਲਡਿੰਗਾਂ ਬਣਾਉਣ ਸਮੇਂ ਸੀਮੈਂਟ ਵਿੱਚ ਮਿਲਾ ਕੇ ਵਰਤਿਆ ਜਾਂਦਾ ਹੈ